ਹਾਂਜੀ ਸਤਿ ਸ਼੍ਰੀ ਅਕਾਲ ਜੀ ਜੇਕਰ ਅਸੀਂ ਪਿਛਲੇ ਸਾਲਾਂ ਵਿੱਚ ਮੋਹਾਲੀ ਦੀ ਗੱਲ ਕਰੀਏ ਤਾਂ ਮੋਹਾਲੀ ਵਿੱਚ ਬਹੁਤ ਹੀ ਜ਼ਿਆਦਾ ਬਦਲਾਵ ਆਇਆ ਜੇਕਰ ਆਪਾਂ ਗੱਲ ਕਰੀਏ ਤਾਂ ਸੜਕਾਂ ਦੀ ਅਤੇ ਅੱਜ ਮੋਹਾਲੀ ਦੇ ਪਿਛਲੇ ਸਾਲਾਂ ਵਿੱਚ ਸੜਕਾਂ ਦਾ ਬਹੁਤ ਹੀ ਜਿਆਦਾ ਸੁਧਾਰ ਹੋਇਆ ਅਤੇ ਮੋਹਾਲੀ ਦੇ ਵਿੱਚ ਬਿਲਡਿੰਗਾਂ ਵੀ ਕਿਉਂ ਬਹੁਤ ਸਾਰੀਆਂ ਨਵੀਆਂ ਬਿਲਡਿੰਗਾਂ ਬਣ ਚੁੱਕੀਆਂ ਹਨ ਅਤੇ ਮੋਹਾਲੀ ਦੇ ਵਿੱਚ ਇੱਕ ਪਿਛਲੇ ਸਾਲਾਂ ਵਿੱਚ ਇਹ ਇੰਟਰਨੈਸ਼ਨਲ ਏਅਰਪੋਰਟ ਬਣਿਆ ਹੈ ਕਿ ਉਹ ਬਹੁਤ ਹੀ ਵਧੀਆ ਹਨ ਅਤੇ ਇੱਕ ਗ ਗਰਾਊਂਡ ਵੀ ਇੰਟਰਨੈਸ਼ਨਲ ਗਰਾਊਂਡ ਬਣ ਗਿਆ ਹੈ